ਹੈਲੋ ਵੀਰੇ ਸਤਿ ਸ਼੍ਰੀ ਅਕਾਲ ਜੀ ਜੀ ਕਿਆ ਹਾਲ ਹੈ ਜੀ ਮੈਂ ਵੀਰਾਂ ਜੀ ਤੁਸੀਂ ਪਛਾਣਿਆ ਨਹੀਂ ਵੀਰਾਂ ਨੀਗਾ ਵਰਿੰਦਰ ਜੀ ਮਾਧੋਵਾਲ ਤੋਂ ਵਧੀਆ ਵਧੀਆ ਵਧੀਆ ਤੁਸੀਂ ਸੁਣਾਓ ਜੀ ਬਸ ਤੁਹਾਨੂੰ ਪਤਾ ਹੀ ਹੈ ਕੰਮਾਂ ਕਾਰਾਂ 'ਚ ਵਿਜੀ ਅੱਜ ਕੱਲ੍ਹ ਸਭ ਵਧੀਆ ਸਭ ਵਧੀਆ ਲੱਗਦਾ ਨੰਬਰ ਸੇਵ ਨੀਗਾ ਮੇਰਾ ਅੱਛਾ ਅੱਛਾ ਅੱਛਾ ਅੱਛਾ ਹੋਰ ਅੰਕਲ ਆਂਟੀ ਠੀਕ ਹੈ ਘਰ ਸਭ ਹੋਰ ਭਬ ਭਾਬੀ ਜੀ ਠੀਕ ਹੈ ਵਧੀਆ ਹੋਰ ਪਿੰਡ ਸਭ ਵਧੀਆ ਵਧੀਆ ਵਧੀਆ ਕੰਮ ਕਾਰ ਚੱਲਦਾ ਰਹਿਣਾ ਚਾਹੀਦਾ ਮੈਂ ਨਾ ਪੁੱਛਣਾ ਸੀਗਾ ਨਾ ਤੁਸੀਂ ਕਿਤਾਬਾਂ ਕਤੂਬਾਂ ਵਗੈਰਾ ਪੜ੍ਹਦੇ ਰਹਿੰਦੇ ਹੈ ਅਤੇ ਮੈਨੂੰ ਨਾ ਕੋਈ ਵਧੀਆ ਕਿਤਾਬ ਦੱਸੋ ਵੀ ਜਿਹੜੀ ਪੰਜਾਬ ਵਾਸਤੇ ਵਧੀਆ ਹੋਵੇ ਪੰਜਾਬ ਦੀ ਜਾਣਕਾਰੀ ਮੰਨ ਲਓ ਵਧੀਆ ਹੋਵੇ ਉਹਦੇ 'ਚ ਅਰਥ ਵਿਵਸਥਾ ਬਾਰੇ ਪੰਜਾਬ ਦੇ ਗੁਰੂਆਂ ਸਿੱਖਾਂ ਬਾਰੇ ਅਤੇ ਹੋਰ ਸਾਰੀ ਬੇਸਿਕ ਜਾਣਕਾਰੀ ਹੋਵੇ ਵਧੀਆ ਮਤਲਬ ਸਾਰੀ ਵਿੱਚ ਹੀ ਹੋਵੇ ਪੰਜਾਬ ਬਾਰੇ ਪੂਰੀ ਨੌਲੇਜ ਜਿਸ 'ਚ ਮਿਲ ਜਾਵੇ ਕਿਤਾਬ 'ਚ ਉਹ ਕਿਤਾਬ ਹੋਵੇ ਤੇ ਵਧੀਆ ਹਾਂਜੀ ਅੱਛਾ ਜੀ ਅੱਛਾ ਜੀ ਸਾਰੀ ਜਾਣਕਾਰੀ ਹੈਗੀ ਮਤਲਬ ਉਹ 'ਚ

ਅੱਛਾ ਜੀ ਅਤੇ ਹੋਰ ਜਾਣੀ ਕਿ ਸਾਡਾ ਪੰਜਾਬ 'ਤੇ ਹੀ ਦੁਗਲ ਵਾਲੀ ਕਿਤਾਬ ਜਾਣੀ ਵਧੀਆ ਰਹਿਣੀ ਪੰਜਾਬ ਦੀ ਨੌਲੇਜ ਵਾਸਤੇ ਅੱਛਾ ਜੀ ਅਤੇ ਇੱਕ ਸਾਡਾ ਪੰਜਾਬ ਨ ਜਿੰਦਲ ਦੀ ਇਹ 'ਚ ਆਪਣੇ ਸਿੱਖ ਸਿੱਖ ਇਤਹਾਸ ਬਾਰੇ ਵੀ ਜਾਣਕਾਰੀ ਮਿਲ ਜਾਣੀ ਇਹਦੇ ਵਿੱਚ ਜੀ

ਅੱਛਾ ਜੀ ਜਾਣੀ ਕਿ ਮੈਂ ਕਿਤਾਬ ਪੜ੍ਹ ਲਵਾਂ ਮੇਰੇ ਵਾਸਤੇ ਵਧੀਆ ਰਹੇਗੀ

ਮੈਂ ਦੇਖਦਾ ਮੈਂ ਕੱਲ੍ਹ ਜਾ ਕੇ ਨਾ ਬਾਏ ਕਰੂੰਗਾ ਕਿਤਾਬ ਇਹ ਖਰੀਦ ਕੇ ਲਿਆਊਂਗਾ ਬਜ਼ਾਰ ਜਾ ਕੇ ਹਾਂ ਇਹ ਵੀ ਕੰਮ ਠੀਕ ਹੈ ਨਾ ਆਪਾਂ ਜਾ ਕੇ ਚੈੱਕ ਕਰਾਂਗੇ ਹੈ ਨਾ ਲੇਟੈਸਟ ਵਰਜਨ ਹੈ ਨਾ ਅਤੇ ਉਹਨਾਂ ਦੀ ਸ਼ਾਇਦ ਮੈਂ ਨਿਊਜ਼ ਪੜ੍ਹੀ ਹੈ ਮਨੀਸ਼ ਇੰਦਰ ਹੋਣੀ ਸਾਡਾ ਪੰਜਾਬ ਦਾ ਨਵਾਂ ਐਡੀਸ਼ਨ ਸ਼ਾਇਦ ਮੈਨੂੰ ਲਾਂਚ ਕਰਿਆ ਉਹਨੇ ਹੈ ਨਾ ਮੈਂ ਦੇਖਿਆ ਸੀਗਾ ਉਹਦਾ ਕੋਈ ਨਾ ਮੈਂ ਲੈ ਕੇ ਆਊਂਗਾ ਜਿੱਦਾਂ ਵੀ ਹੋਇਆ ਹੈ ਨਾ ਫਿਰ ਤੁਹਾਨੂੰ ਮੈਂ ਕਰੂੰਗਾ ਪੜ੍ਹ ਕੇ ਰਿਵਿਊ ਕਰਿਆ ਨਾ ਤੁਹਾਨੂੰ ਮੈਂ ਦੱਸੂੰਗਾ ਕੋਈ ਨਾ ਮਿਲਾਂਗੇ ਪੱਕਾ ਮਿਲਾਂਗੇ ਜੀ ਠੀਕ ਹੈ